ਇਹ ਨਹੀਂ ਕਿ ਖਾਣਾ ਬਣਾਉਣਾ ਸਿਰਫ ਔਰਤਾਂ ਦਾ ਹੀ ਕੰਮ ਹੈ ਮਰਦ ਵੀ ਖਾਣਾ ਬਣਾ ਰ ਬਣਾ ਸਕਦੇ ਹਨ ਸਾਡੇ ਘਰ ਵਿੱਚ ਵੀ ਮਰਦ ਖਾਣਾ ਬਣਾਉਂਦੇ ਹਨ ਜਦੋਂ ਅਸੀਂ ਘਰ 'ਚ ਨਹੀਂ ਹੁੰਦੇ ਜਾਂ ਕਿਤੇ ਗਏ ਹੁੰਦੇ ਹਾਂ ਤਾਂ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਉਹ ਆਪਣੇ ਆਪ ਖਾਣਾ ਬਣਾ ਲੈਂਦੇ ਨੇ ਅਤੇ ਬਹੁਤ ਵਧੀਆ ਖਾਣਾ ਬਣਾਉਂਦੇ ਨੇ ਮੇਰੇ ਮੇਰੇ ਘਰ ਵਿੱਚ ਵੀ ਸਾਰੇ ਮਰਦ ਖਾਣਾ ਬਣਾ ਲੈਂਦੇ ਨੇ ਅਤੇ ਬਹੁਤ ਵਧੀਆ ਖਾਣਾ ਸਵਾਦ ਖਾਣਾ ਬਣਾਉਂਦੇ ਨੇ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਖਾਣਾ ਬਣਾਉਣ 'ਚ ਅਤੇ ਬਹੁਤ ਵਧੀਆ ਖਾਣਾ ਬਣਾਉਂਦੇ ਨੇ ਅਤੇ ਮ ਸੋ ਸਵਾਦ ਲੱਗਦਾ ਹੈ ਉਨ੍ਹਾਂ ਦਾ ਖਾਣਾ ਬਹੁਤ ਬਹੁਤ ਮੇਰੇ ਪਾਪਾ ਜਿਹੜੇ ਆ ਉਹ ਬਹੁਤ ਵਧੀਆ ਖਾਣਾ ਬਣਾਉਂਦੇ ਆ ਉਨ ਉਨ੍ਹਾਂ ਦੀ ਮੈਨੂੰ ਸਬਜ਼ੀ ਬਹੁਤ ਸਵਾਦ ਲੱਗਦੀ ਆ ਅਤੇ ਉਹ ਬਹੁਤ ਬਹੁਤ ਵਧੀਆ ਸ਼ੈਫ ਜਿਵੇਂ ਬਣਾਉਂਦੇ ਆ ਉਨ੍ਹਾਂ ਦਾ ਮੈਨੂੰ ਬਹੁਤ ਵਧੀਆ ਖਾਣਾ ਲੱਗਦਾ ਹੈ